ਜਦੋਂ ਮੈਂ ਸਭ ਤੋਂ ਪਹਿਲਾਂ ਸੁਬਾਹ ਉੱਠਦਾ ਤਾਂ ਮੈਂ ਉੱਠਦੇ ਸਾਰ ਚਾਹ ਦੇ ਕੱਪ ਨਾਲ ਅਖਬਾਰ ਪੜ੍ਹਦਾ ਮੈਂ ਘੱਟੋ ਘੱਟ ਸੁਬਾਹ ਅੱਧਾ ਘੰਟਾ ਅਜੀਤ ਅਖਬਾਰ 'ਤੇ ਅਤੇ ਅੱਧਾ ਘੰਟਾ ਮੈਂ ਦਾ ਟ੍ਰਿਬਿਊਨ ਅਖਬਾਰ 'ਤੇ ਲਾਉਨਾ ਮੈਂ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਉਸ ਤੋਂ ਬਾਅਦ ਖੇਡਾਂ ਨਾਲ ਸੰਬੰਧਿਤ ਖਬਰਾਂ ਮਨੋਰੰਜਨ ਭਰਪੂਰ ਖਬਰਾਂ ਅਤੇ ਵਪਾਰ ਨਾਲ ਸੰਬੰਧਿਤ ਖਬਰਾਂ ਪੜ੍ਹਦਾ ਵੈਸੇ ਮੈਂ ਸਭ ਤੋਂ ਜਿਆਦਾ ਖੇਡਾਂ ਨਾਲ ਜਿਹੜੀਆਂ ਸੰਬੰਧਿਤ ਜਿਹੜੀਆਂ ਖਬਰਾਂ ਪੜ੍ਹਨ ਦੇ ਵਿੱਚ ਮੇਰੀ ਬਹੁਤ ਜ਼ਿਆਦਾ ਰੁਚੀ ਹੈ ਮੈਂ ਖੇਡਾਂ ਦੀਆਂ ਜਿਹੜੀਆਂ ਖਬਰਾਂ ਮੇਨ ਅਖਬਾਰ ਵਿੱਚ ਪੜ੍ਹਦਾ